ਮੈਂ ਇੱਕ ਵਾਰੀ ਉੱਤਰਾਖੰਡ ਗਿਆ ਸੀਗਾ ਉੱਥੇ ਮੋਸਟਲੀ ਲੈਂਗੁਏਜ ਦਾ ਫਰਕ ਪੈ ਰਿਹਾ ਸੀਗਾ ਮੈਨੂੰ ਪੰਜਾਬੀ ਚੰਗੀ ਤਰ੍ਹਾਂ ਆਉਂਦੀ ਸੀ ਬਟ ਮੈਂ ਉੱਥੇ ਜਾ ਕੇ ਜਦ ਕੁਝ ਵਰਡਸ ਬੋਲੇ ਤਾਂ ਉਹਨਾਂ ਨੂੰ ਸਮਝ ਨਹੀਂ ਆ ਰਹੀ ਸੀ ਅਤੇ ਉਹਦੇ ਵਾਸਤੇ ਮੈਂ ਇੰਟਰਨੈੱਟ ਦੀ ਹੈਲਪ ਲਈ ਅਤੇ ਇੰਟਰਨੈੱਟ ਦੇ ਵਿੱਚ ਉਹਦੀ ਉਹ ਸਰਚ ਉਸ ਸ਼ਬਦ ਨੂੰ ਉਹਨਾਂ ਦੀ ਲੈਂਗੁਏਜ ਦੇ ਵਿੱਚ ਜਾਂ ਫਿਰ ਉਹਨੂੰ ਈਜ਼ੀ ਵੇ ਨਾਲ ਕਿੱਦਾਂ ਦੱਸਦੇ ਆ ਮੈਂ ਉਹ ਸਰਚ ਕੀਤਾ ਫਿਰ ਮੈਂ ਉਹਨਾਂ ਦੇ ਨਾਲ ਉਹ ਸ਼ਬਦ ਕਾਫੀ ਸੇਅਰ ਕੀਤੇ ਤਾਂ ਛੋਟੇ ਮੋਟੇ ਆਪਾਂ ਡੇਲੀ ਬੇਸਿਸ ਦੇ ਵਿੱਚ ਦੇਖੀਏ ਤਾਂ ਕਈ ਸ਼ਬਦ ਸਾਡੇ ਪੰਜਾਬੀ ਦੇ ਵੀ ਇੱਦਾਂ ਦੇ ਹੈਗੇ ਆ ਜੋ ਸਾਨੂੰ ਨਹੀਂ ਪਤਾ ਲੱਗਦੇ ਜਾਂ ਕੋਈ ਔਖੇ ਸ਼ਬਦ ਹੈਗੇ ਨੇ ਅਤੇ ਅਸੀਂ ਉਹਨਾਂ ਨੂੰ ਨੈੱਟ ਤੋਂ ਸਰਚ ਕਰਕੇ ਦੱਸਣਾ ਪੈਂਦਾ ਆ ਬਸ ਆਹ ਮੇਨ ਪ੍ਰੋਬਲਮ ਮੈਨੂੰ ਆਈ ਹੈ ਜੋ ਸਭ ਤੋਂ ਵੱਡੀ ਮੈਨੂੰ ਪ੍ਰੋਬਲਮ ਫੇਸ ਹੋਈ ਲੈਂਗੂਏਜ ਡਿਫਰੈਂਸ ਦਾ ਬਹੁਤ ਇਸ਼ੂ ਪੈਂਦਾ ਸਾਨੂੰ ਅਦਰ ਸਟੇਟ ਦੇ ਵਿੱਚ ਸਪੈਸ਼ਲੀ ਫੋਰ ਪੰਜਾਬੀ